ਕਲਾਈਮੇਟ ਚੇਂਜ ਇੱਕ ਬੜਾ ਹੀ ਗੰਭੀਰ ਵਿਸ਼ਾ ਹੈ ਨਾ ਕਿ ਪੰਜਾਬ ਕਰਕੇ ਔਰ ਪੂਰੇ ਭਾਰਤ ਔਰ ਪੂਰੀ ਸੰਸਾਰ ਵਿੱਚ ਹੀ ਕਲਾਈਮੇਟ ਚੇਂਜ ਦਾ ਬਹੁਤ ਹੀ ਜ਼ਿਆਦਾ ਹੋ ਰਿਹਾ ਵਾ ਇਹ ਸਾਰਾ ਕਲਾਈਮੇਟ ਚੇਂਜ ਪੋਲਿਊਸ਼ਨ ਨਾਲ ਔਰ ਇੱਕ ਮਨੁੱਖਤਾ ਦੇ ਹਾਨੀਕਾਰਕ ਤੱਤਵਾਂ ਦੇ ਕਾਰਨ ਹੋ ਰਿਹਾ ਹੈ ਜਿੱਦਾਂ ਕਿ ਗਰਮੀ ਜ਼ਿਆਦਾ ਬਹੁਤ ਜ਼ਿਆਦਾ ਵਧ ਰਹੀ ਹੈ ਔਰ ਸਰਦੀਆਂ 'ਚ ਸਰਦੀ ਬਹੁਤ ਹੋ ਰਹੀ ਕਈ ਵਾਰ ਸਰਦੀ ਜ਼ਿਆਦਾ ਪੈ ਜਾਂਦੀ ਹੈ ਔਰ ਕਈ ਵਾਰ ਗਰਮੀ ਜ਼ਿਆਦਾ ਪੈ ਜਾਂਦੀ ਹੈ ਇਹ ਸਾਰਾ ਪਲਿਊਸ਼ਨ ਨਾਲ ਜਿੱਦਾਂ ਸਕੂਟਰ ਕਾਰਾਂ ਚੋਂ ਨਿਕਲਦਾ ਹੋਇਆ ਧੂੰਆਂ ਕਿਉਂਕਿ ਪੈਦਲ ਬਿਲਕੁਲ ਨਹੀਂ ਚੱਲਦੇ ਸਕੂਟਰ 'ਤੇ ਜਾਂ ਕਾਰਾਂ ਤੇ ਚੱਲਦੇ ਇਸ ਕਰਕੇ ਉਹਨਾਂ ਦਾ ਯੂਜ ਜ਼ਿਆਦਾ ਹੁੰਦਾ ਹੈ ਔਰ ਜਿਹਨਾਂ ਵਿੱਚੋਂ ਧੂਆਂ ਨਿਕਲਣ ਕਰਕੇ ਉਹ ਸਾਰਾ ਹੀ ਵਾਤਾਵਰਨ 'ਚ ਮਿਕਸ ਹੋ ਜਾਂਦਾ ਔਰ ਇਸ ਕਰਕੇ ਕਲਾਈਮੇਟ ਚੇਂਜ ਹੋ ਰਿਹਾ ਜਿੱਦਾਂ ਕਿ ਪਹਾੜਾਂ ਵਿੱਚ ਵੀ ਅੱਜ ਕੱਲ੍ਹ ਮੌਸਮ ਚੇਂਜ ਬਹੁਤ ਜਲਦੀ ਹੋ ਰਿਹਾ ਹੈ ਅਤੇ ਸਾਰਾ ਹੀ ਪੋਲਿਊਸ਼ਨ ਦੇ ਨਾਲ ਹੋ ਰਿਹਾ ਗਰਮੀਆਂ 'ਚ ਗਰਮੀ ਵੱਧ ਜਾਂਦੀ ਹੈ ਔਰ ਏ ਸੀ ਦਾ ਯੂਜ ਬਹੁਤ ਜ਼ਿਆਦਾ ਲੋਕ ਕਰਦੇ ਹੈ ਔਰ ਏ ਸੀ 'ਚ ਨਿਕਲ ਵਾਲੀ ਗਰਮ ਹਵਾਵਾਂ ਜਿਹੜੀਆਂ ਹੈਗੀਆਂ ਵਾ ਉਹ ਵੀ ਮੌਸਮ ਨੂੰ ਵਾਤਾਵਰਨ ਦੇ ਵਿੱਚ ਘੁਲ ਕੇ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਕਰਕੇ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਬਹੁਤ ਹੀ ਹਾਨੀਕਾਰਕ ਨੁਕਸਾਨਦੇਹ ਮਨੁੱਖਤਾ ਵਾਸਤੇ ਬਹੁਤ ਹੀ ਜ਼ਿਆਦਾ ਹੈ ਇਹਦੇ ਵਿੱਚ ਗੰਭੀਰਤਾ ਨਾਲ ਸੋਚਣਾ ਚਾਹੀਦਾ ਜਿਹਨਾਂ ਨੂੰ ਕਿੰਨਾ ਕੁ ਘੱਟ ਕੀਤਾ ਜਾ ਸਕੇ